ਦੇਖੋ ਜੀ ਸਮੇਂ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਹਨ ਅਤੇ ਪਾਣੀ ਦੀ ਅਰੇਂਜਮੈਂਟ ਦੇ ਲਈ ਪਹਿਲਾਂ ਕੀ ਹੁੰਦਾ ਸੀਗਾ ਜਿਹੜਾ ਅਰੇਂਜਮੈਂਟ ਹੁੰਦਾ ਸੀ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈਗਾ ਟੱਬਾਂ ਦੇ ਵਿੱਚ ਜਿਹੜਾ ਹੈਗਾ ਵੱਡੇ ਵੱਡੇ ਟੱਬ ਦੇ ਵਿੱਚ ਜਿਹੜਾ ਪਾਣੀ ਸਟੋਰ ਕਰਕੇ ਰੱਖ ਲਿਆ ਜਾਂਦਾ ਸੀਗਾ ਹੁਣ ਕੀ ਆ ਕਿਉਂਕਿ ਫੈਸਲਿਟੀ ਬਹੁਤ ਸਾਰੀਆਂ ਆ ਗਈਆਂ ਹੈਗੀਆਂ ਨੇ ਅਤੇ ਵੱਡੇ ਵੱਡੇ ਮੈਰਿਜ ਪੈਲੇਸ ਹੈਗੇ ਨੇ ਮੈਰਿਜ ਪੈਲਸਾਂ ਵਿੱਚ ਵਿਆਹ ਹੁੰਦਾ ਹੈਗਾ ਆ ਮੈਰਿਜ ਪੈਲਸਾਂ ਦੇ ਜਿਹੜੇ ਹੈਗੇ ਨੇ ਆਪਣੇ ਆਪਣੇ ਬੋਰਵੈਲ ਹੈਗੇ ਨੇ ਜਾਂ ਸਰਕਾਰੀ ਕੋਲ ਸਪਲਾਈ ਹੈ ਅਤੇ ਨਾਲ ਉਹਨਾਂ ਕੋਲ ਬੋਰਵੈਲ ਵੀ ਹੈਗਾ ਵੈਸੇ ਤੇ ਸਰਕਾਰੀ ਸਪਲਾਈ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਆਪਣੀ ਜਿਹੜੀ ਛੱਤ ਉੱਪਰ ਟੈਂਕੀ ਬਣਾਈ ਹੁੰਦੀ ਹੈਗੀ ਆ ਵਧੀਆ ਕੁਆਂਟਿਟੀ ਉਹ ਕਪੈਸਿਟੀ ਦੀ ਹੁੰਦੀ ਆ ਉਹਦੇ 'ਚ ਉਹ ਪਾਣੀ ਸਟੋਰ ਕਰ ਲੈਂਦੇ ਨੇ ਅਤੇ ਫੰਕਸ਼ਨ ਜਿਹੜਾ ਹੈਗਾ ਵਿਆਹ ਵਾਲਾ ਫੰਕਸ਼ਨ ਜਿਹੜਾ ਹੈਗਾ ਬੜੇ ਹੀ ਆਰਾਮ ਦੇ ਨਾਲ ਭੁਗਤ ਜਾਂਦਾ ਹੈਗਾ ਫਿਰ ਵੀ ਅਗਰ ਕਿਤੇ ਕੋਈ ਦਿੱਕਤ ਆ ਜੇ ਪਾਣੀ ਦੀ ਸਪਲਾਈ ਨੂੰ ਲੈ ਕੇ ਕਿਤੇ ਕੋਈ ਪਾਣੀ ਦੀ ਪਾਈਪ ਫਟ ਜੇ ਮੌਕੇ ਦੀ ਮੌਕੇ 'ਤੇ ਉਹ ਕੀ ਹੈਗਾ ਬੈਕਅਪ ਵਾਸਤੇ ਜਿਹੜਾ ਹੈਗਾ ਆ ਦੋ ਤਿੰਨ ਜਿਹੜੇ ਹੈਗੇ ਨੇ ਵੱਡੇ ਟੈਂਕਰ ਪਾਣੀ ਦੇ ਉਹ ਸਟੋਰ ਕਰਕੇ ਆਪਾਂ ਰੱਖ ਲੈਂਦੇ ਹੈਗੇ ਆ ਤਾਂ ਜੋ ਖੁਦਾ ਨਾ ਖਾਸਤਾ ਕਿਤੇ ਕੋਈ ਮੁਸ਼ਕਿਲ ਆ ਜੇ ਪਾਣੀ ਦੀ ਸਪਲਾਈ ਫਟ ਜੇ ਤੇ ਸਾਡੇ ਕੋਲ ਜਿਹੜਾ ਹੈਗਾ ਟੈਂਕਾ ਵਿੱਚ ਪਾਣੀ ਸਟੋਰ ਹੁੰਦਾ ਹੈਗਾ ਆ ਉਹਦੇ ਨਾਲ ਫਿਰ ਮੌਕੇ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਅਤੇ ਬਹੁਤ ਹੀ ਗੱਲ ਆ ਬੋਰਵੈਲ ਤਾਂ ਹੁੰਦੀ ਹੀ ਹੈਗੇ ਨੇ ਜੇ ਬੋਰਵੈਲ ਦੇ ਵਿੱਚ ਵੀ ਦਿੱਕਤ ਆ ਜੇ ਪਾਣੀ ਦੀ ਸਪਲਾਈ 'ਚ ਕੋਈ ਪ੍ਰੋਬਲਮ ਆ ਜੇ ਅਤੇ ਉਹ ਵਾਟਰ ਟੈਂਕ ਜਿਹੜੇ ਹੈਗੇ ਨੇ ਉਹ ਚੰਗੀ ਕੁਆਂਟਿਟੀ ਦੇ ਹੁੰਦੇ ਨੇ ਕੇਪੈਸਟੀ ਦੇ ਹੁੰਦੇ ਨੇ ਜਿਹਦੇ ਨਾਲ ਸਾਡਾ ਕੰਮ ਸੌਖਾਲਾ ਹੋ ਜਾਂਦਾ ਠੀਕ ਹੈ ਜੀ ਧੰਨਵਾਦ